ਅੱਠ ਅਕਤੂਬਰ ਦੋ ਹਜ਼ਾਰ ਦੋ ਨੌ ਦਸੰਬਰ ਦੋ ਹਜ਼ਾਰ ਛੇ ਸਤਾਰ੍ਹਾਂ ਜਨਵਰੀ ਉੱਨੀ ਸੌ ਸੱਤਰ ਦਸ ਜਨਵਰੀ ਉੱਨੀ ਸੌ ਪਚਾਸੀ ਤੇਰ੍ਹਾਂ ਅਪ੍ਰੈਲ ਉੱਨੀ ਸੌ ਅਠਾਸੀ